ਭੰਗੜਾ ਭੰਗੜਾ ਇੱਕ ਲੋਕ ਨਾਚ ਹੈ ਜੋ ਪੰਜਾਬ ਵਿੱਚ ਬਹੁਤ ਮਸ਼ਹੂਰ ਹੈ ਭੰਗੜਾ ਤੁਰਲੇ ਵਾਲੀ ਪੱਗ ਅਤੇ ਚਾਦਰਾ ਬੰਨ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਇਹ ਢੋਲ ਦੀ ਆਵਾਜ਼ ਉੱਤੇ ਭੰਗੜਾ ਪਾਇਆ ਜਾਂਦਾ ਹੈ ਭੰਗੜਾ ਸਿਹਤ ਲਈ ਬਹੁਤ ਜ਼ਰੂਰੀ ਹੈ ਅਤੇ ਇਹ ਆਪਣੀ ਸਿਹਤ ਨੂੰ ਬਹੁਤ ਤੰਦਰੁਸਤ ਅਤੇ ਵਧੀਆ ਰੱਖਦਾ ਹੈ ਭੰਗੜੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਵੀ ਬਹੁਤ ਲਾਭ ਪਹੁੰਚਾ ਸਕਦੇ ਹਾਂ ਜਿਵੇਂ ਕਿ ਭੰਗੜਾ ਸਾਨੂੰ ਹੱਡਾਂ ਨੂੰ ਅਤੇ ਲੱਤਾਂ ਨੂੰ ਬਾਵਾਂ ਨੂੰ ਮਜਬੂਤ ਰੱਖਦਾ ਹੈ ਅਤੇ ਤਾਕਤ ਦਿੰਦਾ ਹੈ ਇਸ ਨਾਲ ਅਸੀਂ ਬਹੁਤ ਦੇਰ ਐਕਟਿਵ ਰਹਿੰਦੇ ਹਾਂ ਅਤੇ ਅਸੀਂ ਸਾਰੇ ਕੰਮ ਕਰ ਸਕਦੇ ਹਾਂ ਇਹ ਆਪਣੀ ਪੜ੍ਹਾਈ ਅਤੇ ਸਪੋਰਟਸ ਦੇ ਬਹੁਤ ਮਦਦ ਕਰਦਾ ਹੈ ਭੰਗੜਾ ਬਹੁਤ ਹੀ ਜ਼ਰੂਰੀ ਹੈ ਭੰਗੜਾ ਅੱਜ ਕੱਲ੍ਹ ਬਹੁਤ ਮਸ਼ਹੂਰ ਹੋ ਰਿਹਾ ਹੈ ਅਤੇ ਕਾਫੀ ਲੋਕ ਇਹਨੂੰ ਸਿੱਖ ਰਹੇ ਹਨ ਭੰਗੜਾ ਬਹੁਤ ਹੀ ਜ਼ਰੂਰੀ ਹੈ ਭੰਗੜੇ ਨਾਲ ਅਸੀਂ ਬਹੁਤ ਅਲੱਗ ਅਲੱਗ ਗੀਤਾਂ ਉੱਤੇ ਅਤੇ ਢੋਲ ਦੀ ਆਵਾਜ਼ ਉੱਤੇ ਪਾ ਸਕਦੇ ਹਾਂ ਭੰਗੜਾ ਅੱਜ ਕੱਲ੍ਹ ਕਈ ਤਰ੍ਹਾਂ ਦੇ ਹੁੰਦੇ ਹਨ ਅੱਜ ਕੱਲ੍ਹ ਬਾਹਰ ਦੇ ਲੋਕਾਂ ਨੇ ਇਹਨੂੰ ਮੋਡੀਫਾਈ ਕਰ ਦਿੱਤਾ ਹੈ ਅਤੇ ਵਧੀਆ ਜਿਹਾ ਨਾਚ ਬਣਾ ਦਿੱਤਾ ਹੈ